ਹਾਂਜੀ ਖਾਸ ਮੌਕੇ ਐਦਾਂ ਨੇ ਜਦੋਂ ਲੋਕਾਂ ਦੇ ਵਿਆਹ ਸ਼ਾਦੀਆਂ ਦੇ ਉੱਤੇ ਪ੍ਰੋਗਰਾਮ ਹੁੰਦਾ ਜਾਂ ਕੋਈ ਕਿਸੇ ਦੇ ਲੋਹੜੀ ਹੁੰਦੀ ਹੈ ਤਿਉਹਾਰ ਹੁੰਦਾ ਬੱਚੇ ਦੀ ਮੁੰਡੇ ਦੀ ਕੋਈ ਪਹਿਲੀ ਲੋਹੜੀ ਹੋਵੇ ਠੀਕ ਹੈ ਉਦੋਂ ਇਹੋ ਜਿਹੇ ਸਮਾਗਮਾਂ 'ਤੇ ਡਾਂਸ ਹੁੰਦਾ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਅਤੇ ਬਿਨਾ ਡਾਂਸ ਤੋਂ ਡੀ ਜੇ ਲਗਾਏ ਤੋਂ ਨੱਚੇ ਤੋਂ ਲੋਕ ਇਹ ਸਮਝਦੇ ਨੇ ਕਿ ਵੀ ਅਸੀਂ ਇੰਜੋਏ ਨਹੀਂ ਕੀਤਾ ਮਤਲਬ ਮਨੋਰੰਜਨ ਸਹੀ ਨਹੀਂ ਹੋਇਆ ਹੈਗਾ ਤਾਂ ਉੱਥੇ ਡਾਂਸ ਕਰਨਾ ਇੱਕ ਸਭ ਤੋਂ ਜ਼ਰੂਰੀ ਚੀਜ਼ ਮੰਨਦੇ ਨੇ ਠੀਕ ਹੈ ਜੀ ਅਤੇ ਖਾਸ ਕਰਕੇ ਆਪਣਾ ਜਦੋਂ ਕਿਸੇ ਦਾ ਕੋਈ ਸਪੈਸ਼ਲ ਜਿਵੇਂ ਹੁਣ ਐਨਵਰਸਰੀ ਹੋ ਗਈ ਜਾਂ ਫਿਰ ਬੱਚੇ ਦੀ ਬਰਡੇ ਪਾਰਟੀ ਹੋ ਗਈ ਅੱਜ ਕੱਲ੍ਹ ਉਹਨਾਂ ਚੀਜ਼ਾਂ ਦੇ ਉੱਤੇ ਵੀ ਡਾਂਸ ਜਿਹੜਾ ਹੈਗਾ ਇੱਕ ਅਹਿਮੀਅਤ ਮੰਨਿਆ ਜਾਂਦਾ ਵੀ ਹਾਂ ਵੀ ਇਹ ਜ਼ਰੂਰੀ ਹੈ ਤਾਂ ਇਸ ਕਰਕੇ ਲੋਕ ਉਹਦੀ ਵਿਵਸਥਾ ਜਿਹੜੀ ਹੈਗੀ ਆ ਉਹ ਕਰਦੇ ਨੇ ਤਾਂ ਡੀ ਜੇ ਵਾਲੇ ਬੁੱਕ ਕਰਨ ਲੱਗ ਗਏ ਨੇ ਹੁਣ ਬਰਡੇ ਪਾਰਟੀਜ਼ ਦੇ ਉੱਤੇ ਠੀਕ ਹੈ ਜੀ ਐਨਵਰਸਰੀਜ਼ ਦੇ ਉੱਤੇ ਅਤੇ ਵਿਆਹਾਂ ਸ਼ਾਦੀਆਂ 'ਤੇ ਤਾਂ ਹੁੰਦਾ ਹੀ ਹੁੰਦਾ ਉਹ ਤਾਂ ਇੱਕ ਐਂ ਲਾ ਲਉ ਕਿ ਵੀ ਜ਼ਰੂਰੀ ਚੀਜ਼ ਹੈਗੀ ਆ ਉਹ ਤਾਂ ਹੁੰਦੀ ਓ ਹੁੰਦੀ ਹੈ ਅਤੇ ਇਹ ਸਮ ਸਮਾਗਮਾਂ 'ਤੇ ਜਿਹੜਾ ਹੈਗਾ ਤਿਉਹਾਰਾਂ 'ਤੇ ਡਾਂਸ ਕੀਤਾ ਹੀ ਜਾਂਦਾ